ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਹਾਂਜੀ ਦੱਸੋ ਅੱਛਾ ਜੀ ਹਾਂਜੀ ਪੰਜਾਬ ਦੀ ਇਕੋਨਮੀ ਦੀ ਗੱਲ ਕਰ ਰਹੇ ਤੁਸੀਂ ਦੇਖੋ ਜੀ ਪੰਜਾਬ ਸਾਡਾ ਖੇਤੀਬਾੜੀ ਦਾ ਹੈ ਹੱਬ ਹੈਗਾ ਅਤੇ ਉਹਦਾ ਪੂਰੇ ਦੇਸ਼ ਦੀ ਇਕੋਨਮੀ 'ਚ ਬਹੁਤ ਵੱਡਾ ਇਮਪੈਕਟ ਪੈਂਦਾ ਠੀਕ ਹੈ ਜੀ ਅਤੇ ਉੱਪਰੋਂ ਲੁਧਿਆਣਾ ਸਾਡਾ ਟੈਕਸਟਾਈਲ ਇੰਡਸਟਰੀ ਉੱਥੇ ਬਹੁਤ ਵਧੀ ਫੁਲੇ ਦੀ ਆ ਇਸ ਤਰ੍ਹਾਂ ਉਹ ਵੀ ਸਾਡੀ ਇਕੋਨਮੀ 'ਤੇ ਬਹੁਤ ਬੜਾ ਇੰਪੈ ਵੱਡਾ ਇੰਪੈਕਟ ਰੱਖਦਾ ਅਤੇ ਟੂਰਿਜ਼ਮ ਵਗੈਰਾ ਵੀ ਪੰਜਾਬ 'ਚ ਬਹੁਤ ਹੀ ਜ਼ਿਆਦਾ ਅੱਗੇ ਜਾ ਰਿਹਾ ਹੈ ਜਿੱਦਾਂ ਗੋਲਡਨ ਟੈਂਪਲ 'ਚ ਰੋਜ਼ ਇੱਕ ਲੱਖ ਲੋਕ ਇਕੱਠੇ ਹੁੰਦੇ ਹੈ ਠੀਕ ਹੈ ਜੀ ਅਲਗ ਅਲਗ ਜਗ੍ਹਾਵਾਂ 'ਤੇ ਟੂਰਿਸਟ ਆਉਂਦੇ ਇਸ ਤਰ੍ਹਾਂ ਹੀ ਇਕੋਨਮੀ ਫੁੱਲੀ ਜਾ ਰਹੀ ਆ ਹੋਰ ਕੁਝ ਤੁਸੀਂ ਪੁੱਛਨ ਪੁੱਛਣਾ ਹਾਂਜੀ ਸੱਠ ਪ੍ਰਤੀਸ਼ਤ ਇਕੋਨਮੀ ਸਾਡੀ ਪੰਜਾਬ ਦੀ ਕਿਸਾਨਾਂ ਨੇ ਸੰਭਾਲੀ ਦੀ ਆ ਹਾਂਜੀ ਕਾਫੀ ਪ੍ਰੋਫੀ ਪ੍ਰੋਫਿਟ ਹੋ ਰਿਹਾ ਅਤੇ ਕੱਪੜੇ ਦੀ ਇੰਡਸ ਇੰਡਸਟਰੀ ਵੀ ਬਹੁਤ ਅੱਗੇ ਵਧ ਰਹੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਕੋਈ ਗੱਲ ਹਾਂਜੀ